ਟੈਕਨੋਲਜੀ ਨੇ ਵੱਖ ਵੱਖ ਨੌਕਰੀਆਂ ਦੇ ਮੌਕੇ ਖੋਲਣ ਵਿੱਚ ਬੜੀ ਮਦਦ ਕੀਤੀ ਹੈ ਪੁਰਾਣੇ ਜਮਾਨੇ 'ਚ ਕੀ ਹੈ ਕਿ ਇੱਕ ਇੰਪਲੋਮੈਂਟ ਨਿਊਜ਼ ਨਾਮ ਦਾ ਅਖਬਾਰ ਆਉਂਦਾ ਸੀ ਜਾਂ ਅਖਬਾਰ ਦੇ ਵਿੱਚ ਇਸ਼ਤਿਹਾਰ ਦੇਖਦੇ ਸੀ ਫਿਰ ਪਤਾ ਲੱਗਦਾ ਸੀ ਕਿਹੜੀ ਥਾਂ 'ਤੇ ਪੋਸਟ ਨਿਕਲੀ ਹੈ ਤਾਂ ਜ਼ਿਆਦਾਤਰ ਜਿਹੜੀਆਂ ਆਪਣੀ ਸਟੇਟ ਦੇ ਵਿੱਚ ਹੀ ਪਤਾ ਚੱਲਦਾ ਸੀ ਜਿਹੜੇ ਉਸ ਏਰੀਏ ਦੇ ਅਖਬਾਰ ਆਉਂਦੇ ਸੀ ਕਿ ਇੱਥੇ ਕਿਹੜੀ ਪੋਸਟ ਹੈ ਜਾਂ ਕਿਹੜੀ ਨੌਕਰੀ ਨਿਕਲੀ ਆ ਉੱਥੇ ਫਿਰ ਅਸੀਂ ਫਾਰਮ ਜਿਹੜਾ ਹੈ ਉਹ ਭਰ ਕੇ ਅਪਲਾਈ ਕਰਦੇ ਸੀ ਉਸ ਤੋਂ ਬਾਅਦ ਫਿਰ ਉਹ ਪ੍ਰੋਸੈਸ ਹੁੰਦਾ ਸੀ ਬੜਾ ਲੰਬਾ ਟਾਈਮ ਵੀ ਲੱਗਦਾ ਸੀ ਅਤੇ ਪੈਸੇ ਵੀ ਖਰਚ ਹੁੰਦੇ ਸੀ ਹੁਣ ਟੈਕਨੋਲੋਜੀ ਹੈਲਪ ਨਾਲ ਕੀ ਹੈ ਕਿ ਤੁਹਾਨੂੰ ਬੈਠੇ ਬਿਠਾਏ ਇੰਟਰਨੈਟ ਦੀ ਹੈਲਪ ਨਾਲ ਕੰਪਿਊਟਰ ਦੀ ਹੈਲਪ ਨਾਲ ਪਤਾ ਚੱਲ ਜਾਂਦਾ ਵੀ ਕਿੱਥੇ ਨੌਕਰੀ ਹੈ ਤੁਸੀਂ ਪੂਰੇ ਸਟੇਟ ਕੀ ਪੂਰੇ ਕੰਟਰੀ ਜਾਂ ਪੂਰੇ ਵਰਲਡ ਦੇ ਵਿੱਚ ਦੇਖ ਸਕਦੇ ਹੋ ਕਿੱਥੇ ਕਿੱਥੇ ਕਿਹੜੀ ਕਿਹੜੀ ਜੋਬ ਹੈਗੀ ਹੈ ਅਤੇ ਕਿੱਥੇ ਤੁਸੀਂ ਤੁਹਾਡਾ ਬਾਇਓਡਾਟਾ ਕਿੱਥੇ ਫਿੱਟ ਬੈਠਦਾ ਤਾਂ ਉਸ ਦੇ ਤਰੀਕੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਓਪੋਰਚਨਿਟੀ ਮਿਲ ਸਕਦੀ ਹੈ ਅਤੇ ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਉਸ ਦੇ ਨਾਲ ਜਿਹੜਾ ਟਾਈਮ ਵੀ ਬਚਦਾ ਸਮਾਂ ਵੀ ਬਚਦਾ ਪੈਸੇ ਵੀ ਬਚਦੇ ਨੇ ਅਤੇ ਜਿਹੜੀ ਐਫਰਟ ਵੀ ਬਚਦੀ ਹੈ ਤਾਕਤ ਵੀ ਬਚਦੀ ਹੈ ਅਤੇ ਇਸ ਤਰੀਕੇ ਨਾਲ ਕਾਫੀ ਜਿਹੜਾ ਟੈਕਨੋਲਜੀ ਨੇ ਹੈਲਪ ਕੀਤੀ ਹੈ ਦੂਸਰੇ ਪਾਸੇ ਜਿਹੜੀਆਂ ਟੈਕਨੀਕਲ ਡਿਗਰੀਆਂ ਹੈਗੀਆਂ ਜਿਵੇਂ ਕਿ ਇੰਜੀਨੀਅਰਿੰਗ ਹੈ ਡਿਪਲੋਮਾ ਕਰਦੇ ਨੇ ਬੱਚੇ ਪ੍ਰੋਫੈਸ਼ਨਲ ਕੋਰਸ ਕਰਦੇ ਨੇ ਖਾਸ ਕਰਕੇ ਇੰਜੀਨੀਅਰਿੰਗ ਚਾਰ ਸਾਲ ਦਾ ਬੀਟੈਕ ਦਾ ਕੋਰਸ ਹੈ ਉਹ ਕਾਫੀ ਜ਼ਿਆਦਾ ਵਿਦਿਆਰਥੀਆਂ ਵੱਲੋਂ ਅੱਜ ਕੱਲ੍ਹ ਪਸੰਦ ਕੀਤਾ ਜਾਂਦਾ ਅਤੇ ਉਹ ਉਸ ਦੇ ਵਿੱਚ ਕਿਉਂਕਿ ਜੋਬ ਵਗੈਰਾ ਮਿਲਣ ਦੇ ਚਾਂਸ ਜ਼ਿਆਦਾ ਹੁੰਦੇ ਹੈ ਇਸ ਕਰਕੇ ਉਹ ਪਸੰਦ ਕਰਦੇ ਹਨ ਧੰਨਵਾਦ